ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਗੱਲ ਕਰਨੀ ਸੀ ਤੁਹਾਡੇ ਹੋਰ ਸੁਣਾਉ ਕੀ ਹਾਲ ਚਾਲ ਜੀ ਬਾ ਵਧੀਆ ਜੀ ਵਧੀਆ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਇੱਕ ਨਾ ਜਦੋਂ ਤੁਸੀਂ ਸਵੇਰੇ ਬੁਕਰ ਮਾਰਦੇ ਹੋ ਕੂੜਾ ਨਾ ਇਕੱਠਾ ਕਰਕੇ ਨਾ ਸਾਡੇ ਬੂਹੇ ਅੱਗੇ ਨਾ ਕਰਿਆ ਕਰੋ ਅਤੇ ਉਹਨੂੰ ਨਾ ਇਕੱਠਾ ਕਰਕੇ ਅਤੇ ਉਹ ਇੱਦਾਂ ਕਰਿਆ ਕਰੋ ਸਾਡੇ ਬੂਹੇ ਅੱਗੇ ਨਾ ਕਰਿਆ ਕਰੋ ਕਿਉਂਕਿ ਉਹ ਗਲਤ ਪੈਂਦਾ ਵਾ ਇਸ ਕਰਕੇ ਤੁਸੀਂ ਉਹਨੂੰ ਥੋੜ੍ਹਾ ਜਿਹਾ ਪਰੇ ਕਰ ਦਿਆ ਕਰੋ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਬਾਕੀ ਤੁਸੀਂ ਨਾ ਇੱਦਾਂ ਨੂੰ ਕਰਿਆ ਕਰੋ ਜਿੱਦਾਂ ਉਹ ਸਫਾਈ ਨਾ ਧੂੜ ਥੋੜ੍ਹੀ ਜਿਹੀ ਤੁਸੀਂ ਸਫਾਈ ਸਾਫ ਸਫਾਈ ਕਿ ਵਧੀਆ ਰਹਿੰਦੀ ਆ ਅਤੇ ਸਾਫ ਸੁਥਰੀ ਜਗ੍ਹਾ ਹੋਵੇ ਨਾ ਹਾਂਜੀ

ਕਿਉਂਕਿ ਜਿੰਨੀ ਸਫਾਈ ਜ਼ਿਆਦਾ ਹੋਏ ਜ਼ਿਆਦਾ ਬੈਟਰ ਰਹਿੰਦੀ ਆ ਜੀ ਤੁਸੀਂ ਧੰਨਵਾਦ ਜੀ ਤੁਹਾਡਾ ਬਾਕੀ ਕੋਈ ਗੱਲ ਨਹੀਂ ਤੁਸੀਂ ਅੱਗੇ ਤੋਂ ਧਿਆਨ ਰੱਖਣਾ ਜੀ ਠੀਕ ਆ ਜੀ ਚਲੋ ਠੀਕ ਆ ਚਲੋ ਠੀਕ ਹੈ ਮੈਂ ਠੀਕ ਆ ਜੀ ਠੀਕ ਆ ਮੈਂ ਬਾਹਰ ਜਾਣਾ ਜ਼ਰਾ ਬਾਅਦ ਮੈਂ ਕਰਦਾ ਜੀ ਤੁਹਾਨੂੰ ਠੀਕ ਆ ਮਿਹਰਬਾਨੀ ਜੀ ਤੁਹਾਡੀ